ਹੈਲੋ ਸ਼ਾਸ਼ੀਕਾਲ ਜੀ ਹਾਂਜੀ ਕੀ ਚੀਜ਼ ਔਡਰ ਕਰੀ ਸੀ ਜੀ ਤੁਸੀਂ ਕੀ ਚੀਜ਼ ਔਡਰ ਕਰੀ ਸੀ ਤੁਸੀਂ ਹਾਂਜੀ ਹਾਂਜੀ ਕਿੰਨੇ ਹਾਂਜੀ ਕਦੋਂ ਕਰਵਾਏ ਸੀ ਤੁਸੀਂ ਆਰਡਰ ਹਾਂਜੀ ਉਹਨਾਂ ਬਾਰਿਸ਼ ਕਰਕੇ ਤੇ ਕੁਝ ਕਿਸਾਨਾਂ ਨੇ ਧਰਨੇ ਵੀ ਲਗਾਏ ਹੋਏ ਸੀ ਤਾਂ ਕਰਕੇ ਟਰਾਂਸਪੋਰਟ ਵਿੱਚ ਪ੍ਰੋਬਲਮ ਆ ਰਹੀ ਸੀਗੀ ਤਾਂ ਕਰਕੇ ਤੁਹਾਡੀ ਡਿਲੀਵਰੀ ਥੋੜੀ ਲੇਟ ਹੋ ਜਾਏਗੀ ਜੀ ਟਾਈਮ ਪ੍ਰੋਬਲਮ ਚੱਲ ਰਹੀ ਹ ਤਾਂ ਕਰਕੇ ਲੇਟ ਹੋ ਰਹੇ ਬਾਕੀ ਕੋਈ ਗੱਲ ਨਹੀਂ ਸਾਨੂੰ ਤੁਹਾਡਾ ਮਿਲਜੇਗਾ ਆਹ ਵੰਨ ਵੀਕ ਦੇ ਵਿੱਚ ਵਿੱਚ ਵੰਨ ਵੀਕ ਤੱਕ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਕੀ ਜਲਦੀ ਤੋਂ ਜਲਦੀ ਸਾਡਾ ਪਾਰਸਲ ਪਹੁੰਚਾਇਆ ਜਾਏ ਪੈਕਿੰਗ ਹੋ ਗਈ ਐ ਤੇ ਤੁਹਾਨੂੰ ਤਿੰਨ ਚਾਰ ਦਿਨ ਲੱਗ ਜਾਣਗੇ ਪਹੁੰਚਣ ਤੱਕ ਤੁਹਾਡਾ ਸਮਾਨ ਹਾਂਜੀ ਬਾਕੀ ਕੋਈ ਗੱਲ ਨਹੀਂ ਤੁਹਾਡਾ ਤੁਹਾਨੂੰ ਸਮਾਨ ਮਿਲ ਜਾਏਗਾ

ਹਾਂਜੀ ਉਹੀ ਨਾ ਟ੍ਰਾਂਸਪੋਰਟ ਵਿੱਚ ਪ੍ਰੋਬਲਮ ਚੱਲ ਰਹੀ ਹ ਤਾਂ ਕਰਕੇ ਹਾਂਜੀ ਅੱਗੇ ਤੋਂ ਤੁਹਾਨੂੰ ਇਹ ਪ੍ਰੋਬਲਮ ਨਹੀਂ ਆਏਗੀ ਅਸੀਂ ਇਹਦੇ ਬਾਰੇ ਜਰੂਰ ਗੱਲ ਕਰਾਂਗੇ ਅੱਗੇ ਟਰਾਂਸਪੋਰਟ ਨਾਲ ਹਾਂਜੀ ਹੋਰ ਵੀ ਕੁਝ ਮੰਗਵਾਇਆ ਸੀ ਕਿ ਤੁਸੀਂ ਹਾਂਜੀ ਕੋਈ ਹਾਂਜੀ ਕੋਈ ਗੱਲ ਨਹੀਂ ਇਧਰ ਇਦਾਂ ਹੋ ਰਿਹਾ ਅੱਗੇ ਤੋਂ ਨਹੀਂ ਹੋਏਗਾ ਅੱਗੇ ਤੋਂ ਤੁਹਾਡਾ ਸਮਾਨ ਤੁਹਾਨੂੰ ਟੋਏ ਟਾਈਮ ਤੇ ਹਾਂਜੀ ਤੁਸੀਂ ਆਪ ਹਾਂ ਹਾਂਜੀ ਬੱਚੇ ਪੂਰੀ ਕੋਸ਼ਿਸ਼ ਕਰ ਰਹੇ ਆ ਤੁਹਾਡਾ ਵੀ ਪਾਰਸਲ ਐ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਜਿਨਾਂ ਦਾ ਕਿ ਲੇਟ ਹੋ ਰਿਹਾ ਉਹਨਾਂ ਦੀਆਂ ਵੀ ਕੋਲਸ ਆ ਰਹੀਆਂ ਨੇ ਸਾਨੂੰ ਪਰ ਅਸੀਂ ਤੁਹਾਨੂੰ ਜਲਦੀ ਪਹੁੰਚਾਵਾਂਗੇ ਹਾਂਜੀ ਹਾਂਜੀ ਨਹੀਂ ਜੀ ਤੁਸੀਂ ਕੈਂਸਲ ਨਾ ਕਰਨਾ ਜੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਆਪਦੇ ਵੱਲੋਂ ਤੇ ਸਾਡੀ ਵੀ ਇੱਕ ਪ੍ਰੋਬਲਮ ਚੱਲ ਰਹੀ ਹ ਨਹੀਂ ਤਾਂ ਅਸੀਂ ਪਹਿਲਾਂ ਪੂਰੇ ਟਾਈਮ ਤੇ ਪਹੁੰਚਾਉਦੇ ਆਂ ਪਾਰਸਲ ਹਾਂਜੀ ਹਾਂਜੀ ਨਹੀਂ ਜੀ ਅੱਗੇ ਤਾਂ ਨਹੀਂ ਹੋਏਗਾ ਤੁਹਾਡਾ ਪਾਰਸਲ ਲੇਟ ਹਾਂਜੀ ਇਹ ਤਾਂ ਹੈ ਜੀ ਕੰਪਲੇਟ ਕਰ ਸਕਦੇ ਹੋ ਤੁਸੀਂ ਪਰ ਇਹ ਹੁਣ ਐਸਵਲ ਜਾ ਰੀਜਨ ਹੈ ਅਸੀਂ ਜੋ ਤੁਹਾਨੂੰ ਦੱਸ ਦਿੱਤਾ ਕਿ ਬਾਰਿਸ਼ ਵੀ ਚੱਲ ਰਹੀ ਹੈ ਤੇ ਕਿਸਾਨਾਂ ਨੇ ਧਰਨੇ ਵੀ ਲਗਾਏ ਨੇ ਜਿਸ ਕਰਕੇ ਤੁਹਾਡਾ ਲੇਟ ਹੋਇਆ ਪਾਰਸਲ ਹਾਂਜੀ ਦੇਖ ਰਹੇ ਆ ਜੀ ਇਹਦੇ ਬਾਰੇ ਠੀਕ ਆ ਜੀ ਓਕੇ